ਫੋਟੋ ਗਰਾਫਰੀ ਨੂੰ ਸ਼ੌਂਕ ਦੇ ਤੌਰ 'ਤੇ ਬਹੁਤ ਜ਼ਿਆਦਾ ਸਟੂਡੈਂਟ ਬੱਚੇ ਬੱਚੀਆਂ ਆਪਣੇ ਕੋਲ ਮੋਬਾਇਲ ਤੋਂ ਸੈਲਫੀ ਲੈਂਦੀਆਂ ਹਨ ਪਹਾੜਾਂ ਦੇ ਸੈਰ ਕਰਨ ਜਾਂਦੀਆਂ ਕਾਲਜ ਦਾ ਟੂਰ ਲੱਗਦਾ ਪਿਕਨਿਕ ਸਪੋਟ ਹੈ ਮੇਲੇ ਮਸਾਵੇ ਦਿਨ ਤਿਉਹਾਰ ਧਾਰਮਿਕ ਪ੍ਰੋਗਰਾਮ ਰਾਜਨੀਤਿਕ ਪ੍ਰੋਗਰਾਮ ਅਤੇ ਜਿਨ੍ਹਾਂ ਨੂੰ ਸ਼ੌਕ ਹੈ ਉਹ ਇਹਦੇ ਵਿੱਚ ਆਪਣੀ ਆਪਣੀਆਂ ਲੈਂਦੇ ਹਨ ਔਰ ਪੇਸ਼ੇ ਵੱਜੋਂ ਵੀ ਇਹ ਇੱਕ ਬਹੁਤ ਵਧੀਆ ਕੰਮ ਹੈ ਜਿਹਦੇ ਵਿੱਚ ਵਿਆਹ ਸ਼ਾਦੀਆਂ ਅਤੇ ਅੱਛੇ ਅੱਛੇ ਫੰਕਸ਼ਨਾਂ ਦੇ ਵਿੱਚ ਫੋਟੋਗ੍ਰਾਫਰੀ ਕਰਨ ਨਾਲ ਦੁਕਾਨਦਾਰੀ ਅਤੇ ਪੈਸੇ ਅਰਨ ਕਰਨ ਦਾ ਵੀ ਇੱਕ ਤਰੀਕਾ ਹੈ ਇੱਕ ਅੱਛਾ ਫੋਟੋਗ੍ਰਾਫਰ ਹੀ ਵੱਡੇ ਵੱਡੇ ਇਹ ਮੁਕਾਮ 'ਤੇ ਪਹੁੰਚ ਸਕਦਾ ਹੈ ਫਿਲਮ ਇੰਡਸਟਰੀ 'ਚ ਬੜੇ ਬੜੇ ਅੱਛੇ ਫੋਟੋਗ੍ਰਾਫਰਾਂ ਦਾ ਨਾਮ ਵੀ ਲਿਆ ਜਾਂਦਾ ਹੈ ਅਤੇ ਆਮਦਨ ਦਾ ਸਾਧਨ ਵੀ ਬਣਦਾ